ਹੈਲੋ ਹਾਂਜੀ ਏ ਬੀ ਸੀ ਟਰਾਂਸਪੋਰਟ ਕੰਪਨੀ ਤੋਂ ਬੋਲਦੇ ਹੋ ਜੀ ਸਰ ਤੁਹਾਡੇ ਇਸ ਏਜੰਸੀ ਤੋਂ ਮੈਂ ਇੱਕ ਕੈਬ ਬੁੱਕ ਕੀਤੀ ਸੀਗੀ ਲੁਧਿਆਣੇ ਜਾਣ ਲਈ ਅਤੇ ਆਪਣੀ ਜਿਹੜੀ ਗੱਲ ਹੋਈ ਸੀ ਉਹ ਪੰਦਰਾਂ ਸੌ ਰੁਪਏ ਕਿਰਾਏ ਦੇ ਵਿੱਚ ਗੱਲ ਹੋਈ ਸੀ ਕਿ ਕੈਬ ਲੁਧਿਆਣੇ ਤੱਕ ਪੰਦਰਾਂ ਸੌ ਕਿਰਾਇਆ ਹੋਏਗਾ ਪਰ ਲੁਧਿਆਣੇ ਪਹੁੰਚਣ 'ਤੇ ਤੁਹਾਡੇ ਡਰਾਈਵਰ ਵੱਲੋਂ ਮੇਰੇ ਤੋਂ ਅਠਾਰਾਂ ਸੌ ਰੁਪਏ ਮੰਗੇ ਗਏ ਨੇ ਮੈਂ ਡਰਾਇਵਰ ਨੂੰ ਆਖਿਆ ਵੀ ਸੀ ਕਿ ਕੰਪਨੀ ਦੇ ਨਾਲ ਮੇਰੀ ਗੱਲ ਹੋਈ ਹੈ ਪਰ ਡਰਾਇਵਰ ਨੇ ਜਿਹੜੀ ਉੱਥੇ ਜਿੱਦ ਕੀਤੀ ਇਸ ਲਈ ਸ਼ਿਕਾਇਤ ਕਰਨ ਲਈ ਮੈਂ ਤੁਹਨੂੰ ਇਹ ਕਾਲ ਕੀਤੀ ਹੈ ਕਿਰਪਾ ਕਰਕੇ ਆਪਣੇ ਡਰਾਇਵਰ ਨਾਲ ਜਿਹੜੀ ਉਹ ਗੱਲ ਕੀਤੀ ਜਾਵੇ ਗੱਡੀ ਦਾ ਨੰਬਰ ਪੀ ਬੀ ਗਿਆਰਾਂ ਏ ਤੇਤੀ ਗਿਆਰਾਂ ਸੀ ਜੀ ਕਿਰਪਾ ਕਰਕੇ ਉਸ ਡਰਾਈਵਰ ਨਾਲ ਗੱਲ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਜੀ ਧੰਨਵਾਦ